ਹਾਂ ਕਿਰਾਏ ਵਾਲੀ ਬਾਈਕ ਅੱਜ ਕੱਲ੍ਹ ਬਹੁਤ ਫਾਇਦੇਮੰਦ ਹੋ ਰਹੀਆਂ ਨੇ ਇੱਕ ਤਾਂ ਇਹ ਸਸਤੇ ਸਫਰ ਦਾ ਤਰੀਕਾ ਹੈ ਉੱਪਰ ਤੋਂ ਟਰੈਫਿਕ ਵਿੱਚ ਫਸਣ ਦੀ ਟੈਂਸ਼ਨ ਨਹੀਂ ਰਹਿੰਦੀ ਖਾਸ ਕਰ ਜੱਦ ਸ਼ਹਿਰਾਂ ਵਿੱਚ ਪਬਲਿਕ ਟਰਾਂਸਪੋਰਟ ਹਰ ਜਗ੍ਹਾ ਆਸਾਨੀ ਨਾਲ ਮਿਲਦੀ ਤਾਂ ਬਾਈਕ ਲੋਕਾਂ ਲਈ ਵਧੀਆ ਵਿਕਲਪ ਬਣ ਗਈਆਂ ਨੇ ਜੇਕਰ ਦੇਖਭਾਲ ਦੀ ਗੱਲ ਕਰੀਏ ਤਾਂ ਇਹ ਬਾਈਕ ਦੀ ਜਿੰਮੇਦਾਰੀ ਕਿਰਾਏਦਾਰ 'ਤੇ ਵੀ ਹੁੰਦੀ ਹੈ ਸਫਰ ਤੋਂ ਬਾਅਦ ਉਹਨਾਂ ਨੂੰ ਸਹੀ ਜਗ੍ਹਾ ਪਾਰਕ ਕਰਨਾ ਹੈਲਮਟ ਪਹਿਨਣਾ ਅਤੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਕੁਛ ਕੰਪਨੀਆਂ ਆਪਣੇ ਐਪਸ ਵਿੱਚ ਹੈਲਪਲਾਈਨ ਅਤੇ ਮੇਨਟੇਨੈਂਸ ਸਰਵਿਸਿਸ ਵੀ ਦਿੰਦੀਆਂ ਨੇ ਤਾਂ ਜੋ ਬਾਈਕ ਦੀ ਹਾਲਤ ਵਧੀਆ ਬਣੀ ਰਵੇ ਤੁਸੀਂ ਵੀ ਕਦੀ ਇਹ ਕਿਰਾਏ ਵਾਲੀ ਬਾਈਕ ਇਸਤੇਮਾਲ ਕਰਕੇ ਦੇਖਿਓ ਤੁਹਾਨੂੰ ਵੀ ਸੁਵਿਧਾ ਕੰਪਨੀ ਦੀ ਸਭ ਤੋਂ ਵਧੀਆ ਲੱਗੇਗੀ